ਕੰਮ ਤੋਂ ਬਾਹਰ ਮੇਰੇ ਦੋ ਹੀ ਸ਼ੌਕ ਹੈ ਇੱਕ ਮੈਨੂੰ ਆਰਟ ਪਸੰਦ ਹੈ ਦੂਜਾ ਮੈਨੂੰ ਗਾਰਡਨਿੰਗ ਪਸੰਦ ਹੈ ਇਹ ਜਿਹੜਾ ਹੈਗਾ ਸਾਡੀ ਮੈਂਟਲ ਹੈਲਥ ਨੂੰ ਕਾਫੀ ਜ਼ਿਆਦਾ ਰੀਲੈਕਸ ਰੱਖਦੇ ਨੇ ਅਤੇ ਸਾਨੂੰ ਡਿਪਰੈਸ਼ਨ ਅਤੇ ਇਨਸਾਈਟੀ ਤੋਂ ਬਚਾਉਂਦੇ ਹਨ ਸਭ ਦੇ ਅੰਦਰ ਇਹ ਸ਼ੌਕ ਹੋਣੇ ਬਹੁਤ ਜ਼ਰੂਰੀ ਹੈ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਇੱਕ ਖੁਸ਼ਹਾਲ ਜ਼ਿੰਦਗੀ ਜੀ ਸਕੋ